ਹੈਲੋ ਹਾਂਜੀ ਮਿੰਤਰਾਂ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਂ ਬੇਅੰਤ ਕੌਰ ਗੱਲ ਕਰ ਰਹੀ ਹੈ ਮੈਂ ਆਪਣੀ ਮਿੰਤਰਾਂ ਤੋਂ ਲੋਟਿਕ ਲੋਟਸ ਟੈਨਿਕ ਕ੍ਰੀਮ ਖਰੀਦੀ ਸੀ ਅਤੇ ਬਹੁਤ ਹੀ ਮੀਨਜ਼ ਇਫੈਕਟਿਵ ਇੰਨੀ ਵਧੀਆ ਕਰੀਮ ਹੈ ਐਕਚੁਲੀ ਮੈਂ ਮੀਨਜ਼ ਉਹਦੇ ਵਿਊਜ਼ ਦੇਖੇ ਇੰਨੇ ਵਧੀਆ ਸੀ ਬਹੁਤ ਵਧੀਆ ਸਭ ਦੇ ਕਮੈਂਟਸ ਆਏ ਹੋਏ ਸੀ ਬੱਟ ਮੈਂ ਮੀਨਜ਼ ਮੈਨੂੰ ਲੱਗ ਰਿਹਾ ਸੀਗਾ ਵੀ ਮੈਂ ਕਰੀਮ ਖਰੀਦਾਂ ਕਿਸ ਤਰ੍ਹਾਂ ਪਰ ਮੀਨਜ਼ ਇਹ ਕਰੀਮ ਇੰਨੀ ਵਧੀਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੈਸੇ ਮੈਂ ਕਰੀਮ ਖਰੀਦਣ ਤੋਂ ਪਹਿਲਾਂ ਬਹੁਤ ਵਾਰੀ ਸੋਚਦੀ ਹਾਂ ਠੀਕ ਹੈ ਮੈਨੂੰ ਇੱਦਾਂ ਲੱਗਦਾ ਵੀ ਯਾਰ ਪਤਾ ਨਹੀਂ ਮੇਰੇ ਫੇਸ 'ਤੇ ਕੀ ਪ੍ਰੋਬਲਮ ਹੋਊਗੀ ਮੈਂ ਯੂਜ਼ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ ਬੱਟ ਇਹ ਕ੍ਰੀਮ ਇੰਨੀ ਵਧੀਆ ਹੈ ਇੰਨੀ ਇਫੈਕਟਿਵ ਹੈ ਔਰ ਮੀਨਜ਼ ਜਿਸ ਦਿਨ ਮੈਂ ਔਡਰ ਕੀਤੀ ਹੈ ਐਨੀ ਜਲਦੀ ਔਡਰ ਆਇਆ ਪਹਿਲਾਂ ਤਾਂ ਮੈਨੂੰ ਬਹੁਤ ਵਾਰ ਮੈਂ ਕੋਸ਼ਿਸ਼ ਕੀਤੀ ਮੈਨੂੰ ਫਿਰ ਲੱਗਦਾ ਸੀ ਪਤਾ ਨਹੀਂ ਔਡਰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਠੀਕ ਹੈ ਮੇਰਾ ਫੇਸ ਨਾ ਖ਼ਰਾਬ ਹੋ ਜਾਵੇ ਠੀਕ ਹੈ ਪਹਿਲਾਂ ਬਹੁਤ ਕਰੀਮ ਯੂਜ਼ ਕੀਤੀਆਂ ਪਰ ਬੱਟ ਫਿਰ ਮੈਂ ਇਹਦਾ ਔਡਰ ਪਾ ਹੀ ਦਿੱਤਾ ਠੀਕ ਹੈ ਤਿੰਨ ਦਿਨ 'ਚ ਔਡਰ ਆ ਗਿਆ ਔਰ ਜਿਸ ਦਿਨ ਔਡਰ ਆਇਆ ਉਸ ਦਿਨ ਤੁਸੀਂ ਯਕੀਨ ਨਹੀਂ ਮੰਨੋਗੇ ਸ਼ਾਮੀ ਜਦੋਂ ਮੈਂ ਲਗਾਈ ਠੀਕ ਹੈ ਆਪਣਾ ਫੇਸ ਸਾਫ ਕਰਕੇ ਜਿੱਦਾਂ ਉਹਨਾਂ ਨੇ ਯੂਜ਼ ਕਰਨ ਲਈ ਕਿਹਾ ਸੀ ਉੱਦਾਂ ਹੀ ਯੂਜ਼ ਕੀਤੀ ਨੈਕਸਟ ਡੇਅ ਮੋਰਨਿੰਗ ਜਦ ਮੈਂ ਔਫਿਸ ਗਈ ਤਾਂ ਸਾਰੇ ਮੈਨੂੰ ਕਹਿ ਰਹੇ ਸੀ ਕਲੀਗਸ ਮੈਮ ਤੁਸੀਂ ਤਾਂ ਅੱਜ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ ਫੇਸ ਐਨਾ ਇਫੈਕਟਿਵ ਉਹ ਹੋ ਹੋ ਹੋ ਬੱਟ ਮੈਨੂੰ ਇੰਨੀ ਖੁਸ਼ੀ ਹੋਈ ਮੈਨੂੰ ਬਹੁਤ ਹੀ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਠੀਕ ਹੈ ਇਸ ਚੀਜ਼ ਦਾ ਐਕਸਪੀਰੀਅਸ ਮੈਂ ਆਪਦੇ ਫਰੈਂਡਜ ਨੂੰ ਵੀ ਦੱਸਿਆ ਵੀ ਬਹੁਤ ਵਧੀਆ ਕ੍ਰੀਮ ਹੈ ਠੀਕ ਹੈ ਤੁਸੀਂ ਜ਼ਰੂਰ ਲਓ ਲੋਟਸ ਡੀ ਟੈਨ ਠੀਕ ਹੈ ਇੰਨੀ ਵਧੀਆ ਮੀਨਜ਼ ਫੇਸ ਤਾਂ ਮੀਨਜ਼ ਖੁਦ ਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਤੁਹਾਨੂੰ ਕਹਿੰਦਾ ਵੀ ਤੁਸੀਂ ਇੰਨੇ ਸੋਹਣੇ ਲੱਗ ਰਹੇ ਹੋ ਠੀਕ ਹੈ ਆਪਾਂ ਵੈਸੇ ਕੁਝ ਯੂਜ਼ ਨਹੀਂ ਕਰਦੇ ਪਰ ਜਿਹੜੀ ਚੀਜ਼ ਹੁਣ ਇਹ ਤੁਹਾਡੀ ਕ੍ਰੀਮ ਯੂਜ਼ ਕੀਤੀ ਇੰਨੀ ਜ਼ਿਆਦਾ ਮੈਨੂੰ ਖੁਸ਼ੀ ਹੋਈ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਵੀ ਆਪਣੇ ਫਰੈਂਡਸ ਨੂੰ ਵੀ ਕਿਹਾ ਸਪੈਸ਼ਲੀ ਠੀਕ ਹੈ ਉਹਨਾਂ ਨੂੰ ਰਕਮੈਡ ਕੀਤਾ ਹੈ ਤੁਸੀਂ ਜ਼ਰੂਰ ਲਓ ਯੂਜ਼ ਕਰਕੇ ਦੇਖੋ ਠੀਕ ਹੈ ਥੈਂਕ ਯੂ ਸੋ ਮੱਚ ਨੈਕਸਟ ਟਾਈਮ ਵੀ ਮੈਂ ਚਾਹੁੰਦੀ ਹਾਂ ਵੀ ਮੀਨਜ਼ ਮੇਰਾ ਔਡਰ ਇਸੇ ਤਰ੍ਹਾਂ ਮੈਨੂੰ ਜਲਦੀ ਮਿਲਦਾ ਰਹੇ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮੱਚ